ਬੁਣਾਈ ਅਤੇ ਸਿਲਾਈ ਲਈ ਕੁਛ ਬਹੁਤ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹਨ ਜਿਵੇਂ ਕਿ ਜਿਵੇਂ ਕਿ ਅੱਜ ਕੱਲ੍ਹ ਸਿਲਾਈ ਮਸ਼ੀਨਾਂ ਚੱਲਦੀਆਂ ਹਨ ਥਰੈੱਡ ਅਤੇ ਉੱਨ ਕਈ ਤਰ੍ਹਾਂ ਦੇ ਥਰੈੱਡ ਆਉਂਦੇ ਹਨ ਜਿਵੇਂ ਪਤਲੇ ਥਰੈੱਡ ਆਉਂਦੇ ਹਨ ਕੌਟਨ ਦੇ ਥਰੈੱਡ ਆਉਂਦੇ ਹਨ ਅੱਜ ਕੱਲ੍ਹ ਜਿਹੜੀਆਂ ਸਿੰਥੈਟਿਕ ਫਾਈਬਰ ਚੱਲਦੀਆਂ ਹਨ ਜਿਹਦੇ ਕਰਕੇ ਜਿਹੜੀ ਸੂਤੀ ਕੱਪੜੇ ਜਾਂ ਹੋਰ ਸਨਥੈਟਿਕ ਸ਼ਰਟਾਂ ਬਣਦੀਆਂ ਹਨ ਜਿਹੜੇ ਕਿ ਗਰਮੀਆਂ ਦੇ ਵਿੱਚ ਪਾਉਣ ਦੇ ਕੰਮ ਆਉਂਦੀਆਂ ਹਨ ਅਤੇ ਉੱਨ ਉੱਨ ਨਾਲ ਮੋਟੀਆਂ ਕੋਟੀਆਂ ਜਾਂ ਸਵੈਟਰਾਂ ਬਣਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਗਰ ਸਰਦੀਆਂ ਦੇ ਵਿੱਚ ਪਾਉਣ ਦੇ ਕੰਮ ਆਉਂਦੀਆਂ ਹਨ ਅਤੇ ਅੱਜ ਕੱਲ੍ਹ ਤਰੱਕੀ ਹੋ ਰਹੀ ਹੈ ਜਿਵੇਂ ਟੈਕਨੋਲੋਜੀ ਦੇ ਵਿੱਚ ਉਸ ਤਰ੍ਹਾਂ ਕਈ ਤਰ੍ਹਾਂ ਦੀਆਂ ਅੱਜ ਕੱਲ੍ਹ ਮਸ਼ੀਨਾਂ ਚੱਲ ਪਈਆਂ ਹਨ ਜਿਵੇਂ ਕਿ ਅੱਜ ਕੱਲ੍ਹ ਪੈਰਾਂ ਨਾਲ ਬਿਜਲੀ ਨਾਲ ਚੱਲਣ ਵਾਲੀਆਂ ਸਿਲਾਈ ਮਸ਼ੀਨਾਂ ਚੱਲਦੀਆਂ ਹਨ ਜੋ ਕਿ ਆਪਣੇ ਆਪ ਚੱਲਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਅਜਿਹੀਆਂ ਮੌਡਰਨ ਮਸ਼ੀਨਾਂ ਹਨ ਜਿਹਨਾਂ ਦੇ ਵਿੱਚ ਚਿੱਪਸ ਜਾਂ ਡਾਟਾ ਫੀਡ ਕੀਤਾ ਜਾਂਦਾ ਹੈ ਅਤੇ ਉਹ ਖੁਦ ਸਿਲਾਈ ਕਢਾਈ ਕਰਦੀਆਂ ਹਨ ਅਤੇ ਇਸ ਤਰ੍ਹਾਂ ਕਈ ਜਿਹੜੀਆਂ ਟੈਕਨੋਲਜੀਕਲ ਚੀਜ਼ਾਂ ਹਨ ਜਿਹੜੀਆਂ ਕਿ ਲਿਆਉਣ ਦੀ ਲੋੜ ਹੈ ਜਿਵੇਂ ਕਿ ਬਿਜਲੀ 'ਤੇ ਚੱਲਣ ਵਾਲੀਆਂ ਜਿਹੜੀਆਂ ਸਿਲਾਈ ਮਸ਼ੀਨਾਂ ਹਨ ਉਹ ਉਹਨਾਂ ਨੂੰ ਖਰੀਦਣ ਦੀ ਜ਼ਰੂਰਤ ਹੈ